ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਮੈਂ ਸਵੀਗੀ ਤੋਂ ਆਪਣੇ ਖਾਣ ਪੀਣ ਲਈ ਸ਼ਰਮੇ ਢਾਬੇ ਤੋਂ ਬਰਿਆਨੀ ਔਡਰ ਕਰੀ ਸੀ ਜੋ ਕਿ ਜਿਸ ਵਿੱਚ ਮੈਂ ਐਡਰੈੱਸ ਪਹਿਲਾਂ ਕੁਰਾਲੀ ਦਾ ਪਾਇਆ ਸੀ ਅਤੇ ਹੁਣ ਅਸੀਂ ਐਡਰੈੱਸ ਚੇਂਜ ਕਰਨਾ ਚਾਹੁੰਦੇ ਹਾਂ ਜਿਸ ਵਿੱਚ ਕਿ ਮੈਂ ਖੈੜ ਸਨੀ ਇੰਨਕਲੇਵ ਵਿੱਚ ਬਰਿਆਨੀ ਨੂੰ ਮੰਗਵਾਉਣਾ ਚਾਹੁੰਦਾ ਹਾਂ